ਅਕਾਲੀ ਦਲ ਦੇ ਸਿੱਖਿਆ ਮੰਤਰੀ ਚੀਮਾ ਸਾਹਿਬ ਸਾਡੇ ਆਈ ਆਈ ਆਈ ਟੀ ਰੋਪੜ ਵਿਖੇ ਲੈ ਕੇ ਆਏ ਜੋ ਕਿ ਇੱਥੇ ਲਾਗ ਕਿਸੇ ਵੀ ਜ਼ਿਲ੍ਹੇ ਮਾ ਨਹੀਂ ਸੀ ਇਹ ਆਈ ਆਈ ਟੀ ਆਈ ਆਉਣ ਕਾਰਨ ਸਾਡੇ ਜ਼ਿਲ੍ਹੇ ਦੀ ਬਹੁਤ ਖ ਤਰੱਕੀ ਹੋਈ ਅਤੇ ਆਮ ਲੋਕਾਂ ਨੂੰ ਰੁਜ਼ਗਾਰ ਵੀ ਬਹੁਤ ਜ਼ਿਆਦਾ ਮਿਲਿਆ ਅਤੇ ਹੋਰ ਵੀ ਬਹੁਤ ਲੋਕਾਂ ਨੂੰ ਪੈਸਾ ਵੀ ਮਿਲਿਆ ਜ਼ਮੀਨਾਂ ਆਈਆਂ ਆਈ ਆਈ ਟੀ ਵਿੱਚ ਰੁਜ਼ਗਾਰ ਵੀ ਮਿਲਿਆ ਅਤੇ ਬਹੁਤ ਸਹੂਲਤਾਂ ਮਿਲੀਆਂ ਰੋਪੜ ਜ਼ਿਲ੍ਹੇ ਨੂੰ ਅਤੇ ਅਕਾਲੀ ਦਲ ਨੇ ਇਹ ਬੜੀ ਸਹੂਲਤ ਦਿੱਤੀ ਅਕਾਲੀ ਦਲ ਨੇ ਹੀ ਸੜਕਾਂ ਬਹੁਤ ਵਧੀਆ ਬਣਾਈਆਂ ਰੋਪੜ ਜ਼ਿਲ੍ਹੇ ਦੀਆਂ ਅਤੇ ਚੀਮਾ ਸਾਹਿਬ ਦੇ ਕਹਿਣ 'ਤੇ ਅਤੇ ਬਾਦਲ ਸਾਹਿਬ ਨੇ ਵੀ ਚੀਮਾ ਸਾਹਿਬ ਦੇ ਸਿਫਾਰਸ਼ 'ਤੇ ਆਈ ਟੀ ਆਈ ਲਿਆਉਣ ਵਿੱਚ ਬਹੁਤ ਉੱਪਰ ਤੱਕ ਅਪਰੋਚ ਕੀਤੀ ਅਤੇ ਪਾਰਟੀਆਂ ਬਾਕੀ ਬਹੁਤ ਆਈਆਂ ਜਿੱਦਾਂ ਚਰਨ ਸਿੰਘ ਚੰਨੀ ਮਰਿੰਡੇ ਤੋਂ ਮਰਿੰਡਾ ਮਰਿੰਡੇ ਤੋਂ ਮੁੱਖ ਮੰਤਰੀ ਸਾਹਿਬ ਬਣੇ ਸਾਡੇ ਰੋਪੜ ਜ਼ਿਲ੍ਹੇ 'ਚ ਵੀ ਸ਼ਾਨ ਬਣੀ ਅਤੇ ਹੁਣ ਚੱਢਾ ਸਾਹਿਬ ਐਮ ਐਲ ਏ ਹੈ ਰੋਪੜ 'ਚ ਤੇ ਤੋਂ ਅਤੇ ਇਹਨਾਂ ਆਪ ਪਾਰਟੀ ਨੇ ਵੀ ਹੁਣ ਬਿਜਲੀ ਜਿਹੜੀ ਹੈ ਲੋਕਾਂ ਨੂੰ ਫ਼ਰੀ ਦਿੱਤੀ ਅਤੇ ਅਕਾਲੀ ਦਲ ਨੇ ਸਭ ਤੋਂ ਜ਼ਿਆਦਾ ਵਧੀਆ ਕੰਮ ਕੀਤਾ ਅਤੇ ਸਹੂਲਤਾਂ ਲੋਕਾਂ ਨੂੰ ਬਹੁਤ ਦਿੱਤੀਆਂ ਅਤੇ ਖੇਤੀਬਾੜੀ ਲਈ ਬਿਜਲੀ ਫ਼ਰੀ ਦਿੱਤੀ